ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਦੀਪ ਸਿੰਘ ਬੋਲ ਰਿਹਾ ਅਤੇ ਮੈਂ ਪਿਛਲੀ ਵਾਰੀ ਇੱਕ ਟਾਟਾ ਕਾਰ ਅ ਬੁੱਕ ਕੀਤੀ ਸੀ ਸੈਵਨ ਸੀਟਰ ਕਾਰ ਬੁੱਕ ਕੀਤੀ ਸੀ ਅਤੇ ਅੰਮ੍ਰਿਤ ਤਰਨ ਤਾਰਨ ਤੋਂ ਦਿੱਲੀ ਦੀ ਅਤੇ ਉਹ ਭਾਅ ਜੀ ਸਾਹਿਬ ਮੈਨੂੰ ਲੈ ਕੇ ਗਏ ਸੀ ਉਹਨਾਂ ਦੀ ਕਾਰ ਡਰਾਈਵਿੰਗ ਵੀ ਬਹੁਤ ਵਧੀਆ ਸੀ ਅਤੇ ਮੇਰੇ ਲਈ ਬਹੁਤ ਹੀ ਲਾਭਦਾਇਕ ਰਹੀ ਸੀ ਕਿਉਂਕਿ ਮੈਂ ਜੋ ਵੀ ਇਤਿਹਾਸਿਕ ਸਥਾਨ ਵੀ ਵੇਖਣੇ ਸੀ ਤਰਨ ਤਾਰਨ ਤੋਂ ਲੈ ਕੇ ਦਿੱਲੀ ਤੱਕ ਉਹ ਉਹਨਾਂ ਨੇ ਮੈਨੂੰ ਉਹ ਵੀ ਦਿਖਾਏ ਸੀ ਅਤੇ ਨਾਲ ਨਾਲ ਉਹਨਾਂ ਨੇ ਡਰਾਈਵਿੰਗ ਬਹੁਤ ਹੀ ਸਹਿਜ ਅਤੇ ਹਲੀਮੀ ਨਾਲ ਕੀਤੀ ਸੀ ਉਹ ਉਨ੍ਹਾਂ ਨੇ ਪਿਛਲੀ ਵਾਰੀ ਉਹਨਾਂ ਨੇ ਸਾਡੇ ਨਾਲ ਬਹੁਤ ਕੋਪਰੇਟ ਵੀ ਕੀਤਾ ਹਰ ਜਗ੍ਹਾ 'ਤੇ ਸਾਡਾ ਰਸਤੇ ਵਿੱਚ ਉਹਨਾਂ ਨੇ ਸਾਨੂੰ ਹਰ ਜਗ੍ਹਾ ਬਾਰੇ ਵੇਰਵਾ ਵੀ ਦੱਸਿਆ ਸੀ ਅਤੇ ਮੈਂ ਇਸ ਵਾਰ ਵੀ ਉਹੀ ਕਾਰ ਬੁੱਕ ਕਰਨਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਤੁਸੀਂ ਦੱਸ ਸਕਦੇ ਕਿ ਉਹ ਕਾਰ ਅਤੇ ਉਹ ਡਰਾਈਵਰ ਸਾਹਿਬ ਸਾਨੂੰ ਮਿਲਣਗੇ ਅਵੇਲੇਬਲ ਕਿ ਨਹੀਂ ਸ਼ੁਕਰੀਆ